ਹਾਂ ਕਿ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਸਕੂਲਾਂ ਅਤੇ ਕਾਲਜਾਂ ਵਿੱਚ ਬਹੁਤ ਸਾਰੇ ਵਿਗਿਆਨੀਆਂ ਬਾਰੇ ਪੜ੍ਹਾਇਆ ਜਾਂਦਾ ਹੈ ਜਿਨ੍ਹਾਂ ਵਿੱਚੋਂ ਕੁਛ ਵਿਗਿਆਨੀਆਂ ਨੇ ਬਹੁਤ ਅਹਿਮ ਖੋਜਾਂ ਕਰਕੇ ਦਿੱਤੀਆਂ ਹਨ ਆਪਾਂ ਨੂੰ ਅਤੇ ਉਹਨਾਂ ਦੇ ਨਾਮ ਅਬਦੁਲ ਕਲਾਮ ਸੀ ਵੀ ਏ ਰਮਨ ਸਾਰਾ ਬਾਈ ਅਤੇ ਕੁਛ ਅਹਿਮ ਵਿਗਿਆਨੀ ਹਨ ਜਿੱਦਾਂ ਕਿ ਆਪਣੇ ਅਬਦੁਲ ਕਲਾਮ ਨੇ ਬਹੁਤ ਹੀ ਅਹਿਮ ਖੋਜਾਂ ਕਰਕੇ ਦਿੱਤੀਆਂ ਹਨ ਅਤੇ ਭਾਰਤ ਦੇ ਬਹੁਤ ਹੀ ਪ੍ਰਸਿੱਧ ਵਿਗਿਆਨੀ ਹਨ